ਹਾਂਜੀ ਹਾਂਜੀ ਹਾਂਜੀ ਸਨਿਆਰੇ ਤੋਂ ਬੋਲ ਰਹੇ ਹਾਂ ਜੀ ਬਠਿੰਡਾ ਰੋਡ ਬਾਈਪਾਸ 'ਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਬਣਾ ਦਵਾਂਗੇ ਜੀ ਕਿਹੋ ਜਿਹਾ ਡਿਜ਼ਾਇਨ ਚਾਹੀਦਾ ਤੁਹਾਨੂੰ

ਹਾਂਜੀ ਹਾਂਜੀ ਜੀ ਬਣਾ ਦਵਾਂਗੇ ਜੀ ਬਣਾ ਦਵਾਂਗੇ ਬਣਾ ਦਵਾਂਗੇ ਜੀ ਜੀ ਹਾਂਜੀ ਹਾਂਜੀ ਹੈਗੇ ਜੀ ਚਾਂਦੀ ਦੇ ਗਹਿਣੇ ਵੀ ਹੈਗੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਮਿਲ ਜਾਂਦੀਆਂ ਜੀ ਚਾਂਦੀ ਦਾ ਹੈਗਾ ਜੀ ਸਾਡੇ ਕੋਲ ਪੰਜਾਹ ਹਜ਼ਾਰ ਹਾਂ ਹਾਂ ਹਾਂਜੀ ਜੀ ਸੋਨੇ ਜੀ ਸੋਨੇ ਦਾ ਤਰਾਸੀ ਹਜ਼ਾਰ ਜੀ ਕੋਈ ਨਾ ਜੀ ਗਾਹਕ ਤਾਂ ਤੁਸੀਂ ਸਾਡੇ ਪੱਕੇ ਹੀ ਹੋ ਕੋਈ ਨਾ ਜੀ ਤੁਹਾਨੂੰ ਵੱਧ ਨਹੀਂ ਲਗਾਉਂਦੇ ਜੀ ਹਾਂਜੀ ਹਾਂਜੀ

ਕੀ ਬਣਾ ਜੀ ਤੁਸੀਂ ਦੁਕਾਨ 'ਤੇ ਆ ਜਿਓ ਤਾਂ ਅਸੀਂ ਬਣਾ ਦਵਾਂਗੇ ਜੀ ਕਿਹੋ ਜਿਹੇ ਮਰਜ਼ੀ ਬਣਾ ਲਿਓ ਡਿਜਾਈਨ ਸਾਰੇ ਮਿਲ ਜਾਂਦੇ ਆ ਹਾਂਜੀ ਜੀ ਬਣਾ ਦਵਾਂਗੇ ਜੀ ਕਿੰਨੇ ਤੋਲੇ ਦਾ ਬਣਾਉਣਾ ਜੀ ਠੀਕ ਆ ਜੀ ਬਣਾ ਦਵਾਂਗੇ ਜੀ ਪੰਜੇਬਾਂ ਕਿੰਨੇ ਤੋਲੇ ਪੰਜੇਬਾਂ ਕਿੰਨੇ ਤੋਲੇ ਦੀਆਂ ਚਾਹੀਦੀਆਂ ਹਾਂਜੀ ਜੀ ਬਣਾ ਦਵਾਂਗੇ ਜੀ ਜੀ ਲੋਕ ਵਾਲੇ ਬਣਾ ਜੀ ਲੋਕ ਵਾਲੇ ਬਣਾਉਣੇ ਆ ਕਿ ਦੂਜੇ ਬਣਾਉਣੇ ਆ ਬਣਾਉਣੇ ਜੀ ਬਣਾ ਦਵਾਂਗੇ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਜੀ ਠੀਕ ਆ ਜੀ ਜੀ ਠੀਕ ਆ ਜੀ ਆ ਜਾਇਓ ਓਕੇ ਜੀ